ਮੈਂ ਸਵੇਰੇ ਸਭ ਤੋਂ ਪਹਿਲਾਂ ਨਾਹ ਧੋ ਕੇ ਪੂਜਾ ਪਾਠ ਕਰਦੀ ਹਾਂ ਗੁਰਦੁਆਰੇ ਜਾਂਦੀ ਹਾਂ ਉਸ ਤੋਂ ਬਾਅਦ ਮੈਂ ਆਪਣਾ ਰੋਜ਼ਾਨਾ ਕੰਮ ਕਾਜ ਕਰਦੀ ਹਾਂ ਮੈਨੂੰ ਸ਼ੁਰੂ ਤੋਂ ਹੀ ਚਿੱਤਰਕਾਰੀ ਦਾ ਸ਼ੌਂਕ ਸੀ ਮੈਂ ਸਕੂਲ ਦੇ ਸਮੇਂ ਤੋਂ ਹੀ ਚਿੱਤਰਕਾਰੀ ਕਰਦੀ ਆ ਰਹੀ ਹਾਂ ਆਪਣੀ ਇਸ ਕਲਾ ਨੂੰ ਨਿਖਾਰਨ ਦੇ ਲਈ ਆਪਣੇ ਨਜ਼ਦੀਕੀ ਬਣੇ ਕਲਾ ਕੇਂਦਰ ਵਿੱਚ ਅਭਿਆਸ ਕਰਨ ਜਾਂਦੀ ਹਾਂ ਉੱਥੇ ਮੈਂ ਬਹੁਤ ਤਰ੍ਹਾਂ ਦੀਆਂ ਤਸਵੀਰਾਂ ਜਿਵੇਂ ਆਮ ਜ਼ਿੰਦਗੀ ਦੇ ਨਾਲ਼ ਤਾਲੂਕਾਤ ਰੱਖਦੀਆਂ ਤਸਵੀਰਾਂ ਬਣਾਉਣੀਆਂ ਸਿੱਖੀਆਂ ਹਨ ਉੱਥੇ ਆਪਣੇ ਕਲਾ ਨੂੰ ਨਿਖਾਰਨ ਦਾ ਮੌਕਾ ਮਿਲਿਆ ਇਸ ਦਾ ਅਨੁਭਵ ਮੇਰੇ ਜੀਵਨ ਵਿੱਚ ਬਹੁਤ ਵਧੀਆ ਰਿਹਾ ਇਸ ਲਈ ਮੈਂ ਆਪਣਾ ਕਿੱਤਾ ਬਣਾ ਲਿਆ ਅਤੇ ਆਪਣੇ ਕੈਰੀਅਰ ਨੂੰ ਇਸ ਦਿਸ਼ਾ ਵੱਲ ਮੋੜ ਲਿਆ